ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਤੁਸੀਂ ਕੌਣ ਹਾਂਜੀ ਹਾਂਜੀ ਖੁਸ਼ੀ ਹਾਂਜੀ ਖੁਸ਼ੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਅੱਛਾ ਆਪਣੇ ਮਾਹ ਮਹਾਰਾਜਾ ਸਿੰਘ ਕੋਲੇਜ ਕਰਵਾਈ ਹੈ ਤੁਸੀਂ ਹੁ ਹੁਣ ਕਰਵਾਈ ਹੈ ਅੱਛਾ ਅੱਛਾ ਹਾਂਜੀ ਨਹੀਂ ਮੋਸਟ ਵੈਲਕਮ ਹੈ ਤੁਹਾਡਾ

ਹਾਂਜੀ ਵਧੀਆ ਸਾਰਾ ਕੁੱਛ ਤਾਂ ਤੁਸੀਂ ਕਿਵੇਂ ਮਤਲਬ ਅੱਪ ਡਾਊਨ ਕਰਿਆ ਕਰੋਂਗੇ ਕੇ ਇੱਥੇ ਹੋਸਟਲ 'ਚ ਰਹੁੰਗੇ ਕਿਵੇਂ ਹਾਂਜੀ ਹਾਂਜੀ ਵੈਦਰ ਵਗੈਰਾ ਤਾਂ ਦੇਖੋ ਗਰਮੀ ਹੈ ਸਾਰੇ ਪਾਸੇ ਹੁਣ ਤਾਂ ਫਿਰ ਵੀ ਠੀਕ ਹੈ ਮੌਸਮ ਸਹੀ ਹੈ ਅਤੇ ਬਾਕੀ ਆਪਣੇ ਇੱਥੇ ਸਹੂਲਤਾਂ ਹੈਗੀਆਂ ਸਾਰੀਆਂ ਹੋਸਟਲ 'ਚ ਰੂਮ ਵੀ ਮਿਲ ਜਾਂਦੇ ਹੈ ਕੁੜੀਆਂ ਰਹਿੰਦੀਆਂ ਪਾਣੀ ਵਧੀਆ ਸਾਫ਼ ਸੁਥਰਾ ਆਉਂਦਾ ਕੋਈ ਦਿੱਕਤ ਨਹੀਂ ਹਾਂਜੀ ਲਾਈਟ ਵਗੈਰਾ ਤਾਂ ਐਂਈਂ ਹੈ ਨਾ ਕਾਲਜ 'ਚ ਤਾਂ ਅੰਦਰ ਦਾ ਸਿਸਟਮ ਹੈਗਾ ਲਾਈਟ ਜਿਹੜੀ ਦਾ ਆੱਫਿਸ ਦਾ ਉੱਥੇ ਤੁਹਾਨੂੰ ਮਿਲੂਗਾ ਲੇਕਿਨ ਉਹ ਤੁਹਾਨੂੰ ਹੋਸਟਲ 'ਚ ਇਨਵਰਟਰ ਵਗੈਰਾ ਦਾ ਪ੍ਰੋਬਲਮ ਰਹੂਗਾ ਓਥ ਉੱਥੇ ਇਕੱਲੀ ਲਾਈਟ ਦਾ ਹੈਗਾ ਇਨਵਰਟਰ ਵਗੈਰਾ ਨਹੀਂ ਹੈਗਾ ਹਾਂਜੀ ਨਹੀਂ ਕਦੇ ਆ ਵੀ ਜਾਂਦੀ ਕਦੇ ਨਹੀਂ ਵੀ ਬਾਕੀ ਹੁਣ ਮੌਸਮ ਸਹੀ ਚੱਲ ਰਿਹਾ ਠੀਕ ਹੈ ਸਾਰਾ ਕੁਛ ਓਕੇ ਜੀ ਹਾਂਜੀ ਸਟਾਫ ਵਧੀਆ ਹਾਂਜੀ ਘੱਟੋਂ ਘੱਟ ਪੈਂਤੀ ਟੀਚਰਸ ਦਾ ਸਟਾਫ ਹੈਗਾ ਆਪਣੇ ਕੋਲੇਜ 'ਚ ਹਾਂਜੀ ਹਾਂ ਬਾਕੀ ਤੁਸੀਂ ਆਓਂਗੇ ਬੈਠੋਂਗੇ ਤੁਹਾਨੂੰ ਵਧੀਆ ਲੱਗੇਗਾ ਆਓ ਤੁਸੀਂ ਮੋਸਟ ਵੈਲਕਮ ਤੁਹਾਡਾ ਓਕੇ ਜੀ